ਅੱਜ ਦੇ ਦੌਰ ਵਿੱਚ ਅੱਜ ਦੇ ਦੌਰ ਵਿੱਚ ਦੌੜਨਾ ਅਤੇ ਤੁਰਨਾ ਸਭ ਤੋਂ ਮਹੱਤਵਪੂਰਨ ਗੱਲ ਹੈ ਤਾਂ ਜੋ ਆਪਣੇ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਬਣੀ ਰਹੇ ਅਤੇ ਆਪਾਂ ਜਿਵੇਂ ਕਿ ਵੇਖਦੇ ਹਾਂ ਵੀ ਅੱਜ ਕੱਲ੍ਹ ਜ਼ਮਾਨਾ ਆਨਲਾਈਨ ਦਾ ਆ ਗਿਆ ਹੈ ਤਾਂ ਸਾਰਾ ਹੀ ਕੰਮ ਘਰ ਬੈਠੇ ਜਾਂ ਕੁਰਸੀ 'ਤੇ ਬੈਠ ਕੇ ਹੀ ਹੁੰਦਾ ਹੈ ਅਤੇ ਨਾ ਕੋਈ ਅੱਜ ਕੱਲ੍ਹ ਦੌੜਨਾ ਚਾਹੁੰਦਾ ਹੈ ਅਤੇ ਨਾ ਕੋਈ ਅੱਜ ਕੱਲ੍ਹ ਆਪਣੇ ਸਰੀਰ ਦੇ ਵਿਚ ਵਾਸ ਵਾਸਤੇ ਧਿਆਨ ਦਿੰਦਾ ਹੈ ਬਹੁਤ ਘੱਟ ਲੋਕ ਹਨ ਜੋ ਕਿ ਆਪਣੇ ਸਿਹਤ ਵੱਲ ਧਿਆਨ ਦਿੰਦੇ ਹਨ ਅਤੇ ਸਿਹਤ ਨਾ ਨਾਲ ਜੁੜਨ ਜੁੜੇ ਹੋਏ ਕੁਝ ਪਹਿਲੂਆਂ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਦੌੜਨਾ ਤੁਰ ਵਾਕ ਤੁਰਨਾ ਸੈਰ ਕਰਨਾ ਸਵੇਰ ਦੀ ਅਤੇ ਅੱਜ ਕੱਲ੍ਹ ਇਹ ਸਭ ਬਹੁਤ ਘੱਟ ਗਿਆ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਦੌੜਨ ਬਾਰੇ ਜੋ ਕਿ ਤੁਸੀਂ ਆਪਣੇ ਪ੍ਰਸ਼ਨ ਵਿੱਚ ਪੁੱਛਿਆ ਹੈ ਦੌੜ ਵਿੱਚ ਲੋਕ ਹੁਣ ਕਈ ਮੋਟੇ ਲੋਕਾਂ ਨੂੰ ਵੀ ਦੌੜਨਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਜਿਵੇਂ ਆਪਾਂ ਦੇਖ ਰਹੇ ਹਨ ਬਹੁਤ ਸਾਰੇ ਮੀਮਸ ਅਤੇ ਚੁਟਕਲੇ ਮੋਟੇ ਲੋਕਾਂ 'ਤੇ ਹੀ ਬਣ ਕੇ ਆ ਰਹੇ ਹਨ ਲੋਕ ਆਪਣੇ ਮਨੋਰੰਜਨ ਵਾਸਤੇ ਸਿਰਫ਼ ਆਪਣੇ ਮਜੋ ਮਨੋਰੰਜਨ ਵਾਸਤੇ ਹੀ ਲੋਕਾਂ ਨੂੰ ਮੋਟਾ ਮੋਟਾ ਕਹਿ ਰਹੇ ਹਨ ਅਤੇ ਇਹ ਇਹ ਇਸ ਦੇ ਕੁਝ ਨੁਕਸਾਨ ਵੀ ਹਨ ਅਤੇ ਕੁਝ ਇਸ ਦੇ ਫ਼ਾਇਦੇ ਵੀ ਹਨ ਕਈ ਕਈ ਲੋਕਾਂ ਨੂੰ ਤਾਂ ਇਹ ਪ੍ਰੋਤਸਾਹਨ ਦਿੰਦਾ ਹੈ ਕਿ ਤੁਸੀਂ ਵੀ ਕਸਰਤ ਕਰੋ ਅਤੇ ਦੌੜੋ ਅਤੇ ਆਪਣਾ ਭਾਰ ਘਟਾਓ ਤਾਂ ਕੁਝ ਲੋਕ ਇਹੋ ਜਿਹੇ ਮੇਮਸ ਅਤੇ ਚੁਟਕੁਲੇ ਵੇਖ ਕੇ ਅ ਨਿਰਾਸ਼ ਹੋ ਜਾਂਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੇਰੇ ਮਜ਼ਾਕ ਦਾ ਪਾਤਰ ਹਨ ਕਿ ਮੈਂ ਕਿ ਮੈਂ ਇਹਨਾਂ ਦਾ ਮਜ਼ਾਕ ਦਾ ਪਾਤਰ ਹਾਂ ਇਹ ਮੇਰਾ ਮਜ਼ਾਕ ਉਡਾਉਂਦੇ ਹਨ ਪਰ ਕੁਝ ਲੋਕ ਇਸ ਨੂੰ ਬਹੁਤ ਹੀ ਪੋਜੀਟਿਵਲੀ ਤਰੀਕੇ ਨਾਲ ਲੈਂਦੇ ਹਨ ਕੀ ਕੋਈ ਗੱਲ ਨਹੀਂ ਅੱਜ ਇਕ ਮਹੀਨੇ ਦੋ ਮਹੀਨੇ ਠਹਿਰ ਕੇ ਮੈਂ ਇਸ ਨੂੰ ਭਾਰ ਜ਼ਰੂਰ ਆਪਣਾ ਘਟਾ ਕੇ ਦਿਖਾਉਂਗਾ ਅਤੇ ਬਹੁਤ ਸਾਰੇ ਲੋਕ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੇਰਾ ਬਹੁਤ ਮਜ਼ਾਕ ਉਡਾਉਂਦੇ ਹਨ ਅਤੇ ਹੁਣ ਜਿਵੇਂ ਕਿ ਮੈਂ ਇੱਕ ਗੱਲ ਆਪਣੀ ਸਾਂਝੀ ਕਰਨਾ ਚਾਹੁੰਦਾ ਹਾਂ ਕੀ ਮੇਰੇ ਨਾਲ ਇੱਕ ਮੁੰਡਾ ਹੁੰਦਾ ਸੀ ਉਸ ਨੂੰ ਅਸੀਂ ਵੀ ਨਿੱਕੇ ਹੁੰਦੇ ਬਹੁਤ ਕੁਛ ਕਹਿ ਦਿੰਦੇ ਹੁੰਦੇ ਸੀ ਵੀ ਮੋਟਾ ਮੋਟਾ ਪਰ ਉਹ ਅੱਜ ਨੈਸ਼ਨਲ ਲੈਵਲ ਰਨਿੰਗ ਚੈਂਪੀਅਨ ਹੈ ਅਤੇ ਉਹ ਰਿਲੇਅ ਰੇਸਾਂ ਦੇ ਵਿੱਚ ਵੀ ਖੂਬ ਭਾਗ ਲੈਂਦਾ ਹੈ ਅਤੇ ਉਹ ਅੱਜ ਨੈਸ਼ਨਲ ਚੈਂਪੀਅਨ ਹੈ ਧੰਨਵਾਦ ਜੀ